ਦੇਖੋ ਨੈਗਟਿਵ ਐਕਸਪੀਰੀਅੰਸ ਜਿਹੜਾ ਹੈਗਾ ਵਾ ਨਾ ਮੇਰਾ ਉਹ ਮੈਂ ਨਾ ਮੀਸ਼ੋ ਤੋਂ ਮੰਗਵਾਈ ਸੀਗੀ ਕੁਰਤੀ ਪਹਿਲਾਂ ਜਿਹੜਾ ਪ੍ਰ ਪ੍ਰੋਡਕਟ ਆਇਆ ਬਹੁਤ ਹੀ ਵਧੀਆ ਆਇਆ ਜਦੋਂ ਮੈਂ ਦੂਜੀ ਵਾਰ ਮੰਗਵਾਈ ਨਾ ਮੈਂ ਤਾਂ ਬੜੀ ਮੈਨੂੰ ਆ ਸੀ ਕਿ ਚਲੋ ਸੇਲ ਦੇ ਵਿੱਚ ਮੈਨੂੰ ਮਿਲੀ ਹੈ ਅੱਛੀ ਚੀਜ਼ ਹੋਏਗੀ ਅੱਛਾ ਪ੍ਰੋਡਕਟ ਹੋਏਗਾ ਕਿਉਂਕਿ ਮੈਂ ਦੇਖਿਆ ਸੀਗਾ ਉਹਨੂੰ ਪਹਿਲੇ ਜਦੋਂ ਮੈਨੇ ਮੈਂ ਉਹਨੂੰ ਖੋਲ੍ਹਿਆ ਅਤੇ ਜਦੋਂ ਮੈਂ ਉਹਨੂੰ ਪਾਇਆ ਤਾਂ ਉਹਦੀ ਮੈਨੂੰ ਫਿਟਿੰਗ ਹੀ ਨਹੀਂ ਚੰਗੀ ਆਈ ਇੱਕ ਫਿਟਿੰਗ ਚੰਗੀ ਨਹੀਂ ਆਈ ਦੂਜਾ ਉਹ ਇੱਕ ਸਾਈਡ ਤੋਂ ਉਧੜਿਆ ਵੀ ਹੋਇਆ ਸੀ ਫਟਿਆ ਹੋਇਆ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਫਟੇ ਹੋਇਆ ਦੇ ਮੈਨੂੰ ਬੜਾ ਮਨ 'ਚ ਹੋਇਆ ਕਿ ਮੈਂ ਕਿਹਾ ਜੇ ਤਾਂ ਇਹਨਾਂ ਨੇ ਮੈਨੂੰ ਅੱਛੀ ਚੀਜ਼ ਦਿਖਾਈ ਹੈ ਤਾਂ ਮੈਨੂੰ ਫਿਰ ਇਹਨਾਂ ਨੇ ਮਤਲਬ ਉਹ ਦਿਖਾ ਰਹੇ ਨੇ ਐਡਵਰਟਾਈਜਮੈਂਟ ਕਰਦੇ ਪਏ ਨੇ ਆਪਣੀ ਅਤੇ ਫਿਰ ਮੈਨੂੰ ਇਹ ਚੀਜ਼ ਇਹਨਾਂ ਨੇ ਗ਼ਲਤ ਕਿਸ ਤਰ੍ਹਾਂ ਦੇ ਦਿੱਤੀ ਹਾਲਾਂਕਿ ਮੈਂ ਉਹਨਾਂ ਦੇ ਥੱਲੇ ਜਿਹੜੇ ਹੈਗੇ ਸੀ ਪ੍ਰੋਡਕਟ ਉਹ ਵੀ ਪੜ੍ਹਿਆ ਸੀਗਾ ਉਹ ਪੜ੍ਹਨ ਦੇ ਬਾਵਜੂਦ ਵੀ ਉਹ ਚੀਜ਼ ਫਿਰ ਗ਼ਲਤ ਨਿਕਲੀ ਮੈਂ ਉਹਨਾਂ ਨੂੰ ਲਿਖ ਕੇ ਵੀ ਭੇਜਿਆ ਕਿ ਮੈਨੂੰ ਇਹ ਚੀਜ਼ ਜਿਹੜੀ ਆ ਮੈਨੂੰ ਜਿਹੜਾ ਪ੍ਰੋਡਕਟ ਆ ਇਹ ਸਹੀ ਨਹੀਂ ਮਿਲਿਆ ਬਟ ਮੈਨੂੰ ਕੋਈ ਅੱਗੋ ਰਿਸਪੋਂਸ ਨਹੀਂ ਮਿਲਿਆ ਜਿਹਦੇ ਨਾਲ ਮੈਂ ਦੁਬਾਰਾ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਖ਼ਰਾਬ ਰਿਹਾ